ਮੈਂ ਕਾਫੀ ਡਾਂਸ ਮੁਕਾਬਲਿਆਂ ਵਿੱਚ ਭਾਗ ਲਿਆ ਹੈ ਮੈਂ ਸ਼ੁਰੂ ਤੋਂ ਹੀ ਛੋਟੀ ਕਲਾਸ ਤੋਂ ਹੀ ਵੱਡੀ ਕਲਾਸ ਤੱਕ ਕਾਫੀ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਮੈਂ ਇਸ ਕਰਕੇ ਹਿੱਸਾ ਲੈਂਦੀ ਸੀ ਕਿਉਂਕਿ ਡਾਂਸ ਕਰਨਾ ਨੱਚਣਾ ਗਿੱਧਾ ਪਾਉਣਾ ਮੇਰਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੱਕ ਚਾਅ ਰਿਹਾ ਸੀ ਮੈਨੂੰ ਨੱਚਣ ਗਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਮੈਂ ਛੋਟੇ ਹੁੰਦੇ ਕਾਫੀ ਡਾਂਸ ਕੀਤੇ ਨੇ ਇੱਕ ਵਾਰ ਸੱਤਵੀਂ ਜਮਾਤ ਦੇ ਵਿੱਚ ਮੈਂ ਮਤਲਬ ਕਿ ਆਪਣੇ ਸਰਕਾਰੀ ਸਕੂਲ ਵੱਲੋਂ ਨੇੜੇ ਸਾਡੇ ਇੱਕ ਕੋਲੇਜ ਸੀ ਉੱਥੇ ਜਾਣਾ ਸੀ ਡਾਂਸ ਮੁਕਾਬਲੇ ਦੇ ਲਈ ਅਤੇ ਉੱਥੇ ਫਿਰ ਮੈਂ ਸੋਚਿਆ ਕਿ ਮੈਂ ਕਿਹੜੇ ਗਾਣੇ ਅਤੇ ਡਾਂਸ ਕਰਾਂ ਕਿਉਂਕਿ ਗਿੱਧੇ ਲਈ ਤਾਂ ਗਰੁੱਪ ਮਤਲਬ ਕਿ ਗਰੁੱਪ ਚਾਹੀਦਾ ਆ ਪਰ ਮੈਂ ਸ ਇਕੱਲੀ ਨੇ ਡਾਂਸ ਕਰਨਾ ਸੀ ਇਸ ਕਰਕੇ ਫਿਰ ਮੈਂ ਹਿੰਦੀ ਗਾਣਾ ਚੁਣਿਆ ਅਤੇ ਉਹਦੇ ਲਈ ਮੈਂ ਕਾਫੀ ਤਿੰਨ ਚਾਰ ਦਿਨ ਤੋਂ ਹੀ ਪ੍ਰੈਕਟਿਸ ਕਰਨ ਲੱਗ ਗਈ ਸੀ ਪਿਛਲੇ ਦਿਨਾਂ ਤੋਂ ਅਤੇ ਇਹਦੇ ਵਿੱਚ ਮਲਕੀ ਮੈਂ ਮੇਨ ਮੁੱਖ ਕੋਸ਼ਿਸ਼ ਇਹ ਕੀਤੀ ਕਿ ਜਿਹੜਾ ਪੂਰਾ ਸਟੇਜ ਹੈ ਮੈਂ ਉਹਨੂੰ ਮਲਕੀ ਸਮੇਟਾਂ ਆਪਣੇ ਡਾਂਸ ਦੇ ਵਿੱਚ ਤਾਂ ਮੈਂ ਹੌਲੀ ਹੌਲੀ ਕਰਕੇ ਗਾਣੇ ਦੇ ਮੁਤਾਬਿਕ ਆਪਣੇ ਨਵੇਂ ਨਵੇਂ ਸਟੈਪ ਬਣਾਏ ਅਤੇ ਇਵੇਂ ਦੇ ਸਟੈਪ ਕੀਤੇ ਜੋ ਗਾਣਿਆਂ ਦੀਆਂ ਤੁੱਕਾਂ ਨਾਲ ਮੈਚ ਹੋਣ ਤਾਂ ਫਿਰ ਮੈਨੂੰ ਉਹਦੀ ਮੈਂ ਅਭਾ ਅਭਿਆਸ ਕੀਤਾ ਅਤੇ ਮੈਂ ਅਖ਼ੀਰ ਦੇ ਵਿੱਚ ਗਾਣੇ ਦੇ ਆਖ਼ਰੀ ਲਾਇਨਾਂ ਵਿੱਚੋਂ ਇਹ ਕਰਨ ਦੀ ਕੋਸ਼ਿਸ਼ ਕੀਤੀ ਪੂਰਾ ਸਟੇਜ ਸਟੇਜ ਨੂੰ ਆਪਣੇ ਡਾਂਸ ਨਾਲ ਕਵਰ ਕਰਾਂ ਇਸ ਕਰਕੇ ਫਿਰ ਮੈਂ ਜਦੋਂ ਮੈਂ ਡਾਂਸ ਕਰ ਰਹੀ ਸੀ ਤਾਂ ਮੈਂ ਲਾਸਟ ਦੇ ਵਿੱਚ ਪੂਰੀ ਸਟੇਜ ਦੇ ਇੱਕ ਚੱਕਰ ਲਗਾਇਆ ਅਤੇ ਚੱਕਰ ਲਗਾ ਕੇ ਮੈਂ ਪੂਰਾ ਆਪਣਾ ਕ ਸਟੇਜ ਨੂੰ ਕਵਰ ਕੀਤਾ ਅਤੇ ਮਤਲਬ ਬਹੁਤ ਜ਼ਿਆਦਾ ਵਧੀਆ ਸੀ ਅਤੇ ਮੈਨੂੰ ਡਰ ਵੀ ਲੱਗਦਾ ਸੀ ਕਿਉਂਕਿ ਪੂਰਾ ਸਟੇਜ ਕਵਰ ਕਾਫੀ ਵੱਡਾ ਸੀ ਉਹਨੂੰ ਕਵਰ ਕਰਦੇ ਕਰਦੇ ਮੇਰਾ ਸਿਰ ਘੁੰਮਣ ਲੱਗ ਗਿਆ ਸੀ ਬਟ ਪਰ ਮੈਂ ਅਖ਼ੀਰ ਦੇ ਵਿੱਚ ਆ ਕੇ ਉਹ ਸਟੇਜ ਨੂੰ ਬਿਨਾਂ ਗਿਰੇ ਬਿਨਾਂ ਚੱਕਰ ਖਾਏ ਕਵਰ ਕੀਤਾ ਅਤੇ ਮੈਂ ਇੱਕ ਜਗ੍ਹਾ ਆ ਕੇ ਲਾਸਟ ਵੀ ਲਾਸਟ ਦੇ ਵਿੱਚ ਖੜ੍ਹੀ ਹੋ ਗਈ ਅਖ਼ੀਰ ਵਿੱਚ ਅਤੇ ਮੈਂ ਸਾਰੇ ਜਿਹੜੇ ਉੱਥੇ ਬੈਠੇ ਸੀ ਦਰਸ਼ਕ ਉਹਨਾਂ ਨੂੰ ਧੰਨਵਾਦ ਕੀਤਾ ਅਤੇ ਉਸ ਤੋਂ ਬਾਅਦ ਫਿਰ ਮੈਂ ਨੌਵੀਂ ਕੁ ਜਮਾਤ ਦੇ ਵਿੱਚ ਸਾਡੇ ਪੰਦਰ੍ਹਾਂ ਅਗਸਤ ਸੀ ਅਤੇ ਉਹਦੇ ਵਿੱਚ ਅਸੀਂ ਗਿੱਧਾ ਕਰਨਾ ਸੀ ਇਸ ਕਰਕੇ ਫਿਰ ਮੈਂ ਗਿੱਧੇ ਦੇ ਵਿੱਚ ਭਾਗ ਲਿੱਤਾ ਉਹਦੇ ਵਿੱਚ ਸਾਡੇ ਦਸ ਕੁੜੀਆਂ ਸੀ ਅਤੇ ਦਸਾਂ ਕੁੜੀਆਂ ਦੇ ਵਿੱਚ ਮੇਰੀ ਜੋੜੀ ਮੇਰੀ ਸਹੇਲੀ ਅਮਨ ਨਾਲ ਬਣੀ ਜੋ ਕਿ ਬਹੁਤ ਜ਼ਿਆਦਾ ਵਧੀਆ ਗਿੱਧਾ ਪਾਉਂਦੀ ਸੀ ਅਤੇ ਅਸੀਂ ਦੋਵਾਂ ਜਾਣਿਆ ਨੇ ਪਹਿਲਾਂ ਅਸੀਂ ਸਾਰੇ ਗਰੁੱਪ ਨੇ ਸ ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ਗ ਉਸ ਗੀਤ 'ਤੇ ਅਸੀਂ ਸਾਰੇ ਨੱਚੇ ਉਸ ਤੋਂ ਬਾਅਦ ਸਾਡੇ ਇਕੱਲੇ ਇਕੱਲੇ ਦੀ ਬੋਲੀ ਆਉਣ ਲੱਗ ਗਈ ਜਿਵੇਂ ਕਿ ਜਿਵੇਂ ਕਿ ਇੱਕ ਬੋਲੀ ਹੈ ਸੀ ਲੰਘਦਾ ਗਲੀ ਦੇ ਵਿੱਚੋਂ ਬਣ ਬਣ ਕੇ ਮੇਰੀ ਚੁੰਨੀ ਨਾਲ ਦੀਆਂ ਪੱਗਾਂ ਬੰਨ ਬੰਨ ਕੇ ਮੇਰੀ ਚੁੰਨੀ ਨਾਲ ਦੀਆਂ ਪੱਗਾਂ ਬੰਨ ਬੰਨ ਕੇ ਅਤੇ ਅਸੀਂ ਮਤਲਬ ਕਿ ਕਾਫ਼ੀ ਜ਼ਿਆਦਾ ਬੋਲੀਆ 'ਤੇ ਅਸੀਂ ਗਿੱਧਾ ਪਾਇਆ ਸ਼ੁਰੂ ਦੇ ਵਿੱਚ ਮੈਂ ਸਿਰਫ ਮਲ ਮਤਲਬ ਕਿ ਇੰਨਾ ਪਤਾ ਨਹੀਂ ਸੀ ਕਿ ਗਿੱਧਾ ਸਹੀ ਗਿੱਧਾ ਕਿਵੇਂ ਪਾਈਦਾ ਕਿ ਅੱਡੀ ਕਿੰਨੀ ਵਾਰ ਮਾਰੀ ਦੀ ਹੈ ਨੀਚੇ ਅਤੇ ਕਿੰਨੀ ਵਾਰ ਤਾੜੀ ਮਾਰੀ ਦੀ ਆ ਤਾਂ ਅਸੀਂ ਸ਼ੂ ਸ਼ੁਰੂ ਤੋਂ ਹੀ ਮਲਕੀ ਸਿੰਪਲ ਆਮ ਜਾ ਗਿੱਧਾ ਕਰਦੇ ਸੀ ਘਰਾਂ ਵਿੱਚ ਵੀ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਤਾਂ ਅਸੀਂ ਬੋਲੀਆਂ ਕੁੜੀਆਂ ਮੇਰੀ ਭੈਣਾਂ ਅਸੀਂ ਰਲ ਮਿਲ ਕੇ ਜੋ ਬੋਲੀਆਂ ਗਾ ਕੇ ਗਿੱਧਾ ਪਾਉਂਦੀ ਸੀ ਅਤੇ ਉਸ ਤੋਂ ਬਾਅਦ ਇੱਕ ਵਾਰ ਜਦੋਂ ਮੈਂ ਪਲੱਸ ਵਨ 'ਚ ਹੋਈ ਤਾਂ ਪਲੱਸ ਵਨ 'ਚ ਸਾਡਾ ਸਾਰਿਆਂ ਦਾ ਮੁਕਾਬਲਾ ਹੋਇਆ ਅਤੇ ਜਿਹਦੇ ਵਿੱਚੋਂ ਤੀਆਂ ਦਾ ਤਿਉਹਾਰ ਸੀ ਉਹਦੇ ਵਿੱਚ ਚੁਣਨਾ ਸੀ ਕਿ ਪੰਜਾਬਣ ਕੌਣ ਹੈ ਅਸਲੀ ਪੰਜਾਬਣ ਕੌਣ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡਿਆਂ ਇਹ ਉੱਥੇ ਉਹ ਸੀ ਕਿ ਸਾਰੀ ਕੁੜੀਆਂ ਨੇ ਜਾਂ ਤਾਂ ਸੂਟ ਪਾਉਣੇ ਨੇ ਜਾਂ ਤਾਂ ਘੱਗਰੇ ਤਾਂ ਮੈਂ ਉਹਦੇ ਵਿੱਚ ਆਪਣਾ ਘੱਗਰਾ ਪਾਇਆ ਨਾਲ ਆਪਣੀ ਡੋਰੀ ਬੰਨੀ ਸੱਗੀ ਫੁੱਲ ਚੂੜੀਆਂ ਝਾਂਜਰਾਂ ਵਗੈਰਾ ਸਾਰਾ ਕੁਛ ਮੈਂ ਪਾਇਆ ਅਤੇ ਐਨ ਆਪਣਾ ਚੰਗੀ ਤਰ੍ਹਾਂ ਤਿਆਰ ਹੋ ਕੇ ਪੁਰਾਣੀ ਪਨ ਮੁਟਿਆਰ ਵਾਂਗ ਤਿਆਰ ਹੋ ਕੇ ਸਭ ਤੋਂ ਪਹਿਲਾਂ ਸਾਡਾ ਸੀ ਕਿ ਅਸੀਂ ਮੁਟਿਆਰ ਵਾਂਗ ਤੁਰਨਾ ਹੈ ਕਿ ਕਿਵੇਂ ਇੱਕ ਮੁਟਿਆਰ ਤੁਰਦੀ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਸਾਡੇ ਸਾਰਿਆਂ ਨੂੰ ਤੁਰਨ ਦਾ ਮੁਕਾਬਲਾ ਹੋਇਆ ਜਿਹਦੇ ਵਿੱਚ ਪਿੱਛੇ ਪੰਜਾਬੀ ਗਾਣਾ ਚੱਲਦਾ ਸੀ ਅਤੇ ਅਸੀਂ ਸਾਰੀਆਂ ਕੁੜੀਆਂ ਇੱਕ ਇੱਕ ਕਰਕੇ ਉਸ ਗਾਣੇ 'ਤੇ ਤੁਰੀਆਂ ਉਸ ਤੋਂ ਵੱਢ ਸਾਡੀ ਜੋੜੀਆਂ ਬਣਾਈਆਂ ਗਈਆਂ ਜਿਵੇਂ ਚਾਰ ਚਾਰ ਦਾ ਜੋਟਾ ਅਤੇ ਚਾਰ ਚਾਰ ਜੋਟਾ ਆ ਕੇ ਗਾਣੇ ਦੀਆਂ ਔਰ ਪੈਰਾ ਪੈਰਿਆਂ ਦੇ ਵਿੱਚ ਆ ਕੇ ਨੱਚਦੀਆਂ ਸੀ ਅਤੇ ਅਸੀਂ ਉਸ ਪੈਰੇ 'ਤੇ ਨੱਚੇ ਅਤੇ ਬਾਅਦ 'ਚੋਂ ਇਕੱਲੇ ਇਕੱਲੇ ਦੀ ਬੋਲੀ ਹੋਈ ਅਤੇ ਅਸੀਂ ਇਕੱਲੇ ਇਕੱਲੇ ਜਾਣੇ ਆ ਕੇ ਅੱਗੇ ਆ ਕੇ ਨੱਚ ਕੇ ਦਿਖਾਇਆ ਅਤੇ ਬਹੁਤ ਜ਼ਿਆਦਾ ਮਜ਼ਾ ਆਇਆ